ਬਾਰਾਂ ਅਕਤੂਬਰ ਉੱਨੀ ਸੌ ਸਤਾਨਵੇਂ ਬਾਰਾਂ ਨਵੰਬਰ ਉੱਨੀ ਸੌ ਅਠਾਨਵੇਂ ਤੇਰਾਂ ਨਵੰਬਰ ਉੱਨੀ ਸੌ ਸਤਾਨਵੇਂ ਚੌਦਾਂ ਨਵੰਬਰ ਉੱਨੀ ਸੌ ਪਚਾਨਵੇਂ ਇੱਕੀ ਅਕਤੂਬਰ ਉੱਨੀ ਸੌ ਛਿਆਨਵੇਂ